ਹੈਲੋ ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਹਾਂਜੀ ਆਏ ਸੀ ਨਹੀਂ ਤੁਹਾਨੂੰ ਲੱਗਦਾ ਮਤਲਬ ਉਹ ਹੀ ਐਨਕ ਹੈ ਜਿਹੜੀ ਤੁਸੀਂ ਦਿੱਤੀ ਸੀ ਬਣਾਉਣ ਵਾਸਤੇ ਆਪਾਂ ਤਾਂ ਉਹ ਵੀ ਤਿਆਰ ਕੀਤੀ ਹੈ ਹਾਂਜੀ ਵੇਖੀ ਸੀ ਜੀ ਵਾਈਟ ਮਤਲਵ ਕਿ ਸ਼ੀਸ਼ੇ ਵਾਲੀ ਸੀਗੀ ਤੁਹਾਡੀ ਫਰੇਮ ਬਲੈਕ ਸੀਗਾ ਵਾਈਟ ਅ ਸ਼ੀਸ਼ੇ ਸੀਗੇ ਨਹੀਂ ਇਹ ਕਿਵੇਂ ਹੋ ਸਕਦਾ ਕੰਪਲੇਂਟ ਪਾਈ ਸੀਗੀ ਹਾਂਜੀ ਹਾਂਜੀ ਹਾਂਜੀ ਮੈਂ ਪਾਈ ਸੀ ਜੀ ਹਾਂਜੀ ਹਾਂਜੀ ਚਲੋ ਕੋਈ ਨਹੀਂ ਹਾਂਜੀ ਚਲੋ ਕੋਈ ਨਹੀਂ ਤੁਸੀਂ ਵਿਖਾਇਓ ਦੁਬਾਰਾ ਫਿਰ ਆਪਾਂ ਕਰ ਦਾਂਗੇ ਤੁਹਾਡੇ ਕੋਈ ਚੱਕਰ ਨਹੀਂ ਵੇਖ ਲਾਂਗੇ ਨਹੀਂ ਕੋਈ ਨਹੀਂ ਤੁਸੀਂ ਆਪ ਆ ਜਿਓ ਅਤੇ ਦੱਸ ਦਿਓ ਦੁਬਾਰਾ ਆਪਾਂ ਉਵੇਂ ਹੀ ਬਣਾ ਦਾਂਗੇ ਕਈ ਵਾਰੀ ਗਲਤੀ ਹੋ ਹੀ ਜਾਂਦੀ ਹੈ ਇਨਸਾਨ ਤੋਂ ਹਾਂਜੀ ਉਹ ਤਾਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਤੁਸੀਂ ਲੈ ਆਇਓ ਆਪਾਂ ਦੁਬਾਰਾ ਕਰ ਦਾਂਗੇ ਦੁਕਾਨਦਾਰ ਦਾ ਹੁੰਦਾ ਹੀ ਨਹੀਂ ਕਈ ਵਾਰ ਕਈ ਵਾਰੀ ਆਪਣੇ ਹੋਰ ਦਾ ਮਕੈਨਿਕ ਬੈਠੇ ਹੁੰਦੇ ਆ ਕਈ ਵਾਰੀ ਆਪਣੇ ਹੋਰ ਬੰਦੇ ਦੁਕਾਨ 'ਤੇ ਬੈਠੇ ਹੁੰਦੇ ਕਿਉਂਕਿ ਤੁਸੀਂ ਆਪਣੇ ਹੀ ਬੰਦੇ ਹੋ ਅਤੇ ਫਿਰ ਮਕੈਨਿਕ ਜੀ ਧਿਆਨ ਨਹੀਂ ਦਿੱਤਾ ਹੋਣਾ ਮੈਮ ਕੋਈ ਗੱਲ ਨਹੀਂ ਕੁਛ ਮਕੈਨਿਕ ਕੋਲੋਂ ਹੋਈ ਹੋਣੀ ਗਲਤੀ ਨਹੀਂ ਉਹ ਤਾਂ ਚਲੋ ਸਾਡੀ ਗਲਤੀ ਆ ਜਿਹੜੇ ਤੁਹਾਡੀ ਨਹੀਂ ਗੀ ਅਸੀਂ ਆਪਣੀ ਗਲਤੀ ਮੰਨਦੇ ਹਾਂ ਅਤੇ ਤੁਸੀਂ ਆਪ ਆਓ ਫਿਰ ਹੁਣ ਦੱਸੋ ਕਿ ਹੁਣ ਤੁਹਾਨੂੰ ਇਹ ਕੋਈ ਕੰਪਲੇਂਟ ਨਹੀਂ ਮਿਲੇਗੀ ਅਤੇ ਮੈਂ ਖੁਦ ਆਪ ਤਿਆਰ ਕਰਕੇ ਦਊਂਗੀ ਚਲੋ ਤੁਸੀਂ ਆਓ ਇੱਕ ਵਾਰ ਦੁਕਾਨ 'ਤੇ ਫਿਰ ਆਪਾਂ ਵੇਖਦੇ ਹਾਂ ਕੋਈ ਚੱਕਰ ਨਹੀਂ ਘਾਟਾ ਨਫਾ ਤਾਂ ਬਾਅਦ ਹਾਂਜੀ ਹਾਂਜੀ ਨਹੀਂ ਤੁਸੀਂ ਟੈਨਸ਼ਨ ਨਾ ਲਿਓ ਲੈ ਆਓ ਤੁਸੀਂ ਟੈਨਸ਼ਨ ਨਾ ਲਿਓ ਲੈ ਆਓ ਆਪਾਂ ਦੁਬਾਰਾ ਕਰ ਦਾਂਗੇ ਜੀ ਹਾਂਜੀ ਓਕੇ ਜੀ